ਹਾਂਜੀ ਮੈਡਮ ਨਮਸਕਾਰ ਜੀ ਹਾਂਜੀ ਮੈਡਮ ਮੈਂ ਨਾ ਨਰਿੰਦਰ ਸਿੰਘ ਜੀ ਤੋਂ ਤੁਹਾਡਾ ਨੰਬਰ ਲਿਆ ਸੀ ਅਤੇ ਮੈਂ ਇੰਗਲੈਂਡ ਤੋਂ ਆਉਣਾ ਹੈ ਅਗਲੇ ਹਫ਼ਤੇ ਮੋਹਾਲੀ 'ਚ ਅਤੇ ਮੈਨੂੰ ਥੋੜ੍ਹੀ ਜਿਹੀ ਇੰਨਫ਼ਾਰਮੇਸ਼ ਹਾਂਜੀ ਮੈਨੂੰ ਥੋੜ੍ਹੀ ਜਿਹੀ ਇੰਨਫ਼ਾਰਮੇਸ਼ਨ ਦੇ ਦਿਉ ਅਤੇ ਮੈਨੂੰ ਥੋੜ੍ਹਾ ਦੱਸੋ ਇੱਥੋਂ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਜੀ ਮੋਹਾਲੀ 'ਚ ਅਤੇ ਤੁਹਾਡੇ ਕਹਿਣ ਦਾ ਮਤਲਬ ਕਿ ਮੈਨੂੰ ਕੋਈ ਹੈਵੀ ਕੱਪੜੇ ਲਿਆਉਣ ਦੀ ਲੋੜ ਹੈ ਜਾਂ ਨਹੀਂ ਹਾਂਜੀ ਹਾਂਜੀ ਓਕੇ ਜੀ ਓਕੇ ਓਕੇ ਅਤੇ ਬਾਰਿਸ਼ ਕਿੰਨੀ ਕੁ ਪੈਂਦੀ ਜੀ ਇਸ ਟਾਈਮ ਓਕੇ ਜੀ ਓਕੇ ਜੀ ਓਕੇ ਓਕੇ ਜੀ ਓਕੇ ਜ਼ਰੂਰ ਅਤੇ ਇੱਕ ਦੱਸਿਉ ਕਿ ਘੁੰਮਣ ਲਈ ਕਿਹੜੀ ਕਿਹੜੀ ਜਗ੍ਹਾ ਹੈ ਜੀ ਮੋਹਾਲੀ 'ਚ ਮੋਹਾਲੀ 'ਚ ਦੱਸ ਦਿਉ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਓਕੇ ਜੀ ਓਕੇ ਓਕੇ ਜੀ ਓਕੇ ਅਤੇ ਸ਼ੋਪਿੰਗ ਮਾਲ ਕਿਹੜੇ ਨੇ ਆਪਣੇ ਕਿੰਨੇ ਕੁ ਕਿੰਨੇ ਕੁ ਹੈਗੇ ਨੇ ਮੋਹਾਲੀ 'ਚ ਓਕੇ ਜੀ ਅਤੇ ਕਿਹੜੀ ਕਿਹੜੀ ਓਕੇ ਜੀ ਅਤੇ ਕਿਹੜੀ ਕਿਹੜੀ ਆਈਟਮ ਮਿਲ ਜਾਂਦੀ ਸ਼ੋਪਿੰਗ ਮਾਲ ਦੇ ਵਿੱਚ ਇਜ਼ੀਲੀ ਮਿਲ ਜਾਂਦੀ ਜਿਹੜੀ ਓਕੇ ਓਕੇ ਹਾਂਜੀ ਓਕੇ ਜੀ ਓਕੇ ਓਕੇ ਓਕੇ ਰੈਸਟੋਰੈਂਟ ਵਗੈਰਾ ਕਿਹੜਾ ਮਸ਼ਹੂਰ ਹੈ ਜੀ ਮੋਹਾਲੀ ਦੇ ਵਿੱਚ ਅੱਛਾ ਜੀ ਓਕੇ ਜੀ ਓਕੇ ਓਕੇ ਓਕੇ ਓਕੇ ਜੀ ਓਕੇ ਅਤੇ ਕੋਈ ਖਾਸ ਢਾਬਾ ਕੋਈ ਹੋਵੇ ਜਿਹੜਾ ਖਾਣ ਪੀਣ ਵਾਲਾ ਓਕੇ ਜੀ ਓਕੇ ਜੀ ਚਲੋ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਚਲੋ ਅਗਲੇ ਹਫ਼ਤੇ ਅਸੀਂ ਪਲੈਨ ਕਰ ਰਹੇ ਆਉਣ ਦਾ ਜੀ ਅਤੇ ਉਦੋਂ ਤੁਹਾਨੂੰ ਮਿਲਾਂਗੇ ਜੀ ਓਕੇ ਜੀ ਥੈਂਕਸ